ਭੰਗੜਾ ਸਾਡੇ ਪੰਜਾਬ ਦਾ ਬਹੁਤ ਹੀ ਜ਼ਰੂਰੀ ਸੱਭਿਆਚਾਰਕ ਅਤੇ ਲੋਕ ਨਾਚ ਹੈ ਭੰਗੜੇ ਦੇ ਕਈ ਸਟੈਪ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਭੰਗੜਾ ਸ਼ੁਰੂ ਕਰਦੇ ਹਾਂ ਤਾਂ ਧਰਤੀ ਮਾਂ ਨੂੰ ਪ੍ਰਣਾਮ ਕਰਦੇ ਹਾਂ ਫਿਰ ਹੇਕ ਲਗਾਉਂਦੇ ਹਾਂ ਫਿਰ ਛਾਲਾਂ ਸਟੈਪ ਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਛਾਲ ਮਾਰ ਕੇ ਇਹ ਵਾਲਾ ਸਟੈਪ ਕਰਦੇ ਹਾਂ ਅਤੇ ਦੂਸਰਾ ਪਹਿਲੀ ਧਮਾਲ ਸਟੈਪ ਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਆਪਣੀਆਂ ਬਾਵਾਂ ਉੱਪਰ ਕਰਕੇ ਅਤੇ ਸੱਜੇ ਹੱਥ ਨੂੰ ਉੱਪਰ ਕਰਕੇ ਇਹ ਵਾਲਾ ਸਟੈਪ ਕਰਦੇ ਹਾਂ ਦੂਜੀ ਧਮਾਲ ਵਿੱਚ ਅਸੀਂ ਆਪਣੇ ਇਕ ਸੱਜੀ ਲੱਤ ਨੂੰ ਤਾਂਹ ਕਰਕੇ ਆਪਣੀ ਦੋਵੇਂ ਬਾਹਵਾਂ ਨੂੰ ਘੁਮਾਉਣੇ ਹਾਂ ਤੀਜੀ ਧਮਾਲ ਵਿੱਚ ਅਸੀਂ ਬਾਹਵਾਂ ਨੂੰ ਸਾਈਡਾਂ ਉੱਪਰ ਕਰਕੇ ਚੱਕ ਕੇ ਭੰਗੜਾ ਪਾਉਂਦੇ ਹਾਂ ਇਸ ਵਿੱਚ ਅਸੀਂ ਲੁੱਡੀ ਵੀ ਪਾਉਂਦੇ ਹਾਂ ਲੁੱਡੀ ਦੇ ਕਈ ਸਟੈਪ ਹਨ ਜਿਵੇਂ ਇੱਕ ਤਾੜੀ ਨਾਲ ਲੁੱਡੀ ਪਾਉਣੀ ਅਤੇ ਘੁੰਮ ਕੇ ਲੁੱਡੀ ਪਾਉਣੀ ਇਹ ਸਟੈਪ ਬਹੁਤ ਹੀ ਇੰਪੋਰਟੈਂਟ ਹਨ ਭੰਗੜੇ ਲਈ ਜੋ ਕਿ ਲੁੱਡੀ ਪਿੱਛੇ ਵੱਲ ਨੂੰ ਪਾਉਂਦੇ ਹਾਂ ਇਹਨਾਂ ਸਟੈਪਾਂ ਸਟੈੱਪਸ ਤੋਂ ਬਿਨਾਂ ਭੰਗੜਾ ਅਧੂਰਾ ਹੈ ਸਾਨੂੰ ਭੰਗੜਾ ਪਾਉਣ ਦੇ ਟਾਈਮ ਇਹਨਾਂ ਸਟੈਪਸ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਇਹਦੇ ਵਿੱਚ ਜਿਵੇਂ ਲਹਿਰੀਆ ਲਹਿਰੀਆ ਬਹਿ ਕੇ ਸਿਆਲਕੋਟੀ ਫੋਕ ਹੋ ਗਿਆ ਸਿਆਲਕੋਟੀ ਚਾਲ ਹੋ ਗਿਆ ਇਹ ਕੁਝ ਸਟੈਪ ਹਨ ਭੰਗੜੇ ਦੇ ਅਤੇ ਇਹ ਸੱਭਿਆਚਾਰ ਦੇ ਜੋਰਦਾਰ ਜਸ਼ਨ ਦੀ ਸੁਭਾਅ ਕਿਵੇਂ ਪਾਉਂਦੇ ਹਨ ਇਹ ਸਾਡਾ ਇਕ ਮਨੋਰੰਜ ਮਨੋਰੰਜਨ ਦਾ ਸਾਧਨ ਹੈ ਜਿਸ ਨੂੰ ਭੰਗੜੇ ਨੂੰ ਦੇਖ ਕੇ ਸਾਡੇ ਮਨ ਵਿੱਚ ਇਹ ਭਾਵ ਉੱਠਦਾ ਹੈ ਕਿ ਅਸ ਸਾ ਅਸੀਂ ਵੀ ਭੰਗੜਾ ਕਰੀਏ ਮਨ ਵਿੱਚ ਨੱਚਣ ਦੀ ਉਤਸਾਹਨਾ ਵੱਧਦੀ ਹੈ ਇਹ ਸਾਡੇ ਸੁਭਾਅ ਦੀ ਅਸੀਂ ਬਹੁਤ ਜਦੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ ਤਾਂ ਅਸੀਂ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਜਦੋਂ ਕਿਸੇ ਨੂੰ ਭੰਗੜਾ ਪਾਉਂਦੇ ਦੇਖਦੇ ਹਾਂ ਤਾਂ ਸਾਡੇ ਮਨ ਵਿੱਚ ਵੀ ਭੰਗੜਾ ਪਾਉਣ ਦੀ ਉਤਸਾਹਨਾ ਵੱਧ ਜਾਂਦੀ ਹੈ